ਮੈਂ ਆਪਣੀ ਸਾਈਕਲ ਦੀ ਦੇਖਭਾਲ ਬਹੁਤ ਧਿਆਨ ਨਾਲ ਕਰਦਾ ਹਾਂ ਮੈਂ ਹਮੇਸ਼ਾ ਉਸ ਨੂੰ ਸਾਫ਼ ਰੱਖਦਾ ਹਾਂ ਅਤੇ ਮੈਂ ਹਮੇਸ਼ਾਂ ਉਸਦੀਆਂ ਬਰੇਕਾਂ ਅਤੇ ਚੈਨ ਵਗੈਰਾ ਨੂੰ ਬਹੁਤ ਸੰਭਾਲ ਕੇ ਅਤੇ ਉਸ ਉੱਤੇ ਕੋਈ ਵੀ ਅਜਿਹੀ ਚੀਜ਼ ਨਹੀਂ ਸੁੱਟਦਾ ਜਿਸ ਨਾਲ ਕਿ ਮੇਰੀ ਸਾਈਕਲ ਦਾ ਨੁਕਸਾਨ ਹੋਵੇ ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਲੰਬੇ ਰੂਟ ਉੱਤੇ ਥਕਾਵਟ ਹੋ ਸਕਦੀ ਹੈ ਕਿਉਂਕਿ ਸਾਈਕਲ ਚਲਾਉਣ ਵਿੱਚ ਸਾਡੀਆਂ ਲੱਤਾਂ ਦੀ ਵੀ ਬਹੁਤ ਜਾਨ ਅਤੇ ਜ਼ੋਰ ਲੱਗਦਾ ਹੈ ਜਿਸ ਨਾਲ ਸਾਨੂੰ ਸਾਹ ਵੀ ਚੜ੍ਹ ਸਕਦਾ ਹੈ ਅਤੇ ਕਈ ਵਾਰ ਲੰਬੇ ਰੂਟਾਂ ਉੱਤੇ ਮੈਂ ਬਹੁਤ ਪ੍ਰੇਰਿਤ ਰਹਿੰਦਾ ਹਾਂ ਕਿਉਂਕਿ ਲੰਬੇ ਰੂਟ ਹਮੇਸ਼ਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਹੀ ਵੀ ਹੁੰਦੇ ਹਨ ਕਿਉਂਕਿ ਉਹਨਾਂ ਉੱਤੇ ਸਾਈਕਲ ਚਲਾਉਣਾ ਇੱਕ ਬਹੁਤ ਅਹਿਮ ਗੱਲ ਹੈ ਅਤੇ ਸਾਈਕਲ ਚਲਾਉਣ ਨਾਲ ਸਾਡੀਆਂ ਲੱਤਾਂ ਵਿੱਚ ਕਾਫੀ ਜ਼ੋਰ ਪੈਦਾ ਹੁੰਦਾ ਹੈ